ਭੰਗੜਾ ਐਰੋਬਿਸ ਦੋ ਚੀਜ਼ਾਂ ਨਾਲ ਮਿਲ ਕੇ ਬਣਿਆ ਹੈ ਪਹਿਲਾ ਤਾਂ ਇਹਦੇ 'ਚ ਹੁੰਦੇ ਆ ਵੀ ਭੰਗੜਾ ਭੰਗੜਾ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਬਈ ਇਹ ਨਾਚ ਆਪਣਾ ਮੁੱਖ ਤੌਰ 'ਤੇ ਬਸੰਤ ਦੀ ਫਸਲ ਅਤੇ ਤਿਉਹਾਰ ਵਿਸਾਖੀ ਨਾਲ ਜੁੜੇ ਹੋਏ ਸੀ ਤੇ ਅਤੇ ਇਹ ਫਸਲ ਦੇ ਪ੍ਰਮੁੱਖ ਉਤਪਾਦਾਂ ਵਿੱਚੋਂ ਇੱਕ ਹੁੰਦੀ ਸੀ ਭੰਗ ਭੰਗ ਇਹਦੇ 'ਚ ਹੀ ਭੰਗੜੇ ਨੇ ਆਪਣਾ ਨਾਮ ਖਿਚਿਆ ਬਈ ਅਤੇ ਦੂਜਾ ਬਈ ਅਰੋਬਿਕਸ ਅਰੋਬਿਕਸ ਨੂੰ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਬਈ ਅੱਜ ਕੱਲ੍ਹ ਕਾਫੀ ਚੱਲ ਰਿਹਾ ਹੈਗਾ ਬਈ ਆਪਣੇ ਸਰਾਰੀ ਸਾਰੀਰਕ ਕਸਰਤ ਦਾ ਇੱਕ ਰੂਪ ਹੀ ਹੈਗਾ ਇਹ ਜੋ ਸਾਰੇ ਸਰੀਰ ਦੀ ਤੰਦਰੁਸਤੀ ਵਿੱਚ ਸੁਧਾਰ ਕਰਨ ਲਈ ਕੀਤਾ ਜਾਂਦਾ ਐਰੋਬਿਸ ਆਮ ਤੌਰ 'ਤੇ ਸੰਗੀਤ 'ਤੇ ਪੇਸ਼ ਕੀਤਾ ਜਾਂਦਾ ਹੈ ਅਤੇ ਇਹਨਾਂ ਦੋਵਾਂ ਦਾ ਸਮੂਹ ਮਿਲ ਕੇ ਬਣਾਉਂਦਾ ਭੰਗੜਾ ਐਰੋਬਿਕਸ ਅਤੇ ਜਿਹਦੇ 'ਤੇ ਆਪਣੇ ਇੱਕ ਗਤੀਸ਼ੀਲ ਅਤੇ ਦਿਲਚਸਪ ਕਸਰਤ ਬਣਦੀ ਹੈ ਜੋ ਭੰਗੜਾ ਡਾਂਸ ਕਿ ਜੋ ਮੂਮੈਂਟਸ ਨੂੰ ਤੰਦਰੁਸਤੀ ਅਭਿਆਸ ਨਾਲ ਜੋੜਦੀ ਹੈ ਇਸ ਵਿੱਚ ਬਹੁਤ ਸਾਰੀਆਂ ਗਤੀਵਿਧੀਆਂ ਸ਼ਾਮਿਲ ਹਨ ਜਿਸ ਵਿੱਚ ਚਾਲਾਂ ਸਕੁਐਡਸ ਕਿੱਕਾ ਅਤੇ ਪਾਂ ਦੀਆਂ ਹਰਕਤਾਂ ਸ਼ਾਮਿਲ ਹਨ ਜੋ ਸਾਰੇ ਆਪਣੇ ਸਰੀਰ ਦੀ ਤੰਦਰੁਸਤੀ ਲਈ ਵਧੀਆ ਰਹਿੰਦੀ ਹੈ ਚੰਗੀ ਰਹਿੰਦੀ ਹੈ ਅਤੇ ਇਹਦਾ ਸੁਮੇਲ ਜ ਹੈਗਾ ਭੰਗੜਾ ਅਤੇ ਐਰੋਬਿਸ਼ ਦਾ ਇਹ ਆਪਣੇ ਵੱਖ ਵੱਖ ਮਾਸਪੇਸ਼ੀਆਂ ਸਮੂਹ ਨੂੰ ਨਿਸ਼ਾਨਾ ਬਣਾਉਂਦਾ ਹੈ ਅਤੇ ਆਪਣੀ ਸਾਰੀ ਸਿਹਤ ਦਾ ਸੁਧਾਰ ਕਰਦਾ ਹੈ ਅਤੇ ਸਮੁੱਚੀ ਤਾਕਤ ਅਤੇ ਲਚਕਤਾ ਨੂੰ ਵਧਾਉਂਦਾ ਹੈ ਅਤੇ ਮੈਨੂੰ ਭੰਗੜਾ ਐਰੋਬਿਕਸ ਸਭ ਤੋਂ ਪਹਿਲਾਂ ਪਤਾ ਲੱਗਿਆ ਸੀ ਇੰਟਰਨੈਟ ਤੋਂ ਕੁਛ ਵੀਡੀਓਜ਼ ਦੇਖੀਆਂ ਮੈਂ ਫਿਰ ਮੈਂ ਕਿਤੇ ਜਿੰਮ ਗਿਆ ਸੀ ਤਾਂ ਜਿੰਮ ਮੈਨੂੰ ਪਤਾ ਲੱਗਿਆ ਸੀ ਜਿੰਮ 'ਚ